ਕਿਤਾਬਾਂ ਤੋਂ ਇਲਾਵਾ ਮੈਂ ਅਖਬਾਰ ਪੜ੍ਹਦੀ ਹਾਂ ਅਖਬਾਰ ਵਿੱਚ ਮੈਨੂੰ ਪਤਾ ਲੱਗਦਾ ਵਾ ਵੀ ਏ ਸੋਨੇ ਦਾ ਅੱਜ ਕੀ ਰੇਟ ਆ ਚਾਂਦੀ ਦਾ ਕੀ ਏ ਰੇਟ ਆ ਪ੍ਰਧਾਨ ਮੰਤਰੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਮੈਨੂੰ ਸਭ ਕੁਛ ਪਤਾ ਲੱਗਦਾ ਆ ਨਵੇਂ ਸ਼ਹਿਰ ਦੀਆਂ ਖਬਰਾਂ ਦਾ ਪਤਾ ਲੱਗਦਾ ਵਾ ਅਤੇ ਕੋਈ ਐਕਸੀਰੈਂਟ ਹੋਇਆ ਜਾਂ ਕੁਛ ਆ ਕੋਈ ਬੱਚਾ ਚੱਕਿਆ ਆ ਜਾਂ ਕੁਛ ਆ ਮੈਨੂੰ ਸਾਰਾ ਕੁਛ ਪਤਾ ਲੱਗਦਾ